ਹੈਲੋ ਤੁਸੀਂ ਸਵੀਗੀ ਤੋਂ ਗੱਲ ਕਰਦੇ ਪਏ ਹੋ ਮੈਂ ਤੁਹਾਡੇ ਰੈਸਟੋਰੈਂਟ ਵਿੱਚ ਕੌਫੀ ਦਾ ਔਡਰ ਕੀਤਾ ਸੀ ਮੈਂ ਉਸਦੀ ਪੇਮੈਂਟ ਜਿਹੜੀ ਔਨਲਾਈਨ ਕਰ ਦਿੱਤੀ ਹੈ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਉਸਦੀ ਪੇਮੈਂਟ ਜਿਹੜੀ ਆ ਤੁਹਾਨੂੰ ਪਹੁੰਚ ਗਈ ਆ ਜਾਂ ਨਹੀਂ ਹਜੇ ਪਹੁੰਚੀ ਸਾਡੇ ਘਰ ਰਿਸ਼ਤੇਦਾਰ ਆਏ ਹੋਏ ਨੇ ਜਿਨ੍ਹਾਂ ਵਾਸਤੇ ਮੈਂ ਵੀਹ ਕੱਪ ਕੌਫੀ ਦਾ ਔਡਰ ਕੀਤਾ ਸੀ ਤੁਸੀਂ ਮੈਨੂੰ ਇਹ ਕਨਫਰਮ ਕਰਕੇ ਦੱਸ ਸਕਦੇ ਹੋ ਕਿ ਉਸਦੀ ਜਿਹੜੀ ਪੈਕਿੰਗ ਹੈ ਉਹ ਧਿਆਨ ਨਾਲ ਪਹੁੰਚ ਜਾਵੇਗੀ ਜਾਂ ਉਸਨੂੰ ਪਲਾਸਟਿਕ ਦੇ ਕੰਟੇਨਰ ਜਾਂ ਕੈਂਡੀ ਵਿੱਚ ਪਾ ਕੇ ਹੀ ਭੇਜਿਆ ਜਾਵੇ ਤਾਂ ਕਿ ਕੌਫੀ ਕਿਤੇ ਖ਼ਰਾਬ ਨਾ ਹੋਵੇ ਅਤੇ ਜਾਂ ਫਿਰ ਉਹ ਠੰਡੀ ਨਾ ਹੋ ਜਾਵੇ ਤੁਸੀਂ ਮੈਨੂੰ ਇਹੀ ਦੱਸ ਸਕਦੇ ਹੋ ਕਿ ਜਿਹੜੇ ਬੰਦੇ ਨੇ ਡਿਲੀਵਰੀ ਕਰਨ ਆਉਣਾ ਹੈ ਉਹ ਟਾਈਮ ਨਾਲ ਪਹੁੰਚ ਜਾਵੇਗਾ ਜਾਂ ਨਹੀਂ ਪਹੁੰਚੇਗਾ ਇਸ ਤੁਸੀਂ ਮੈਨੂੰ ਇਹ ਵੀ ਕਨਫਰਮ ਕਰਕੇ ਦੱਸੋ ਕਿ ਇਸ ਨੂੰ ਇਸ ਵਿੱਚ ਲੀਕ ਹੋਣ ਦੀ ਕੋਈ ਸੰਭਾਵਨਾ ਨਾ ਹੋਵੇ ਜਿਹੜੇ ਕੱਪ ਮੈਂ ਵੀਹ ਕੱਪ ਕੌਫੀ ਦਾ ਔਡਰ ਕੀਤਾ ਹੈ ਉਹ ਸਹੀ ਸਲਾਮਤ ਪਹੁੰਚ ਜਾਣ